ਹੈਲੋ ਗੁਰਦਾਸਪੁਰ ਚਲੋਗੇ ਜਾਣਾ ਕਿੱਥੋਂ ਭਾਅ ਜੀ ਭਲਾ ਤੁਸੀਂ ਦੀਨਾਨਗਰ ਤੋਂ ਗੁਰਦਾਸਪੁਰ ਕਿੰਨੇ ਬੰਦੇ ਹੋ ਓਪਰੇਸ਼ਨ ਕਿਹੜਾ ਪੱਥਰੀ ਦਾ ਹੋਏ ਦਾ ਅਤੇ ਮਹਾਰਾਜ ਇਕੱਲੇ ਬੰਦੇ ਉਹ ਅਤੇ ਦੀਨਾਨਗਰ ਤੋਂ ਗੁਰਦਾਸਪੁਰ ਤੋਂ ਭਾਅ ਜੀ ਦੇਖੋ ਤੀਹ ਰੁਪਏ ਸਵਾਰੀ ਚਲੇ ਕਰਦੀ ਹੈ ਇੱਕ ਤਾਂ ਤੀਹ ਰੁਪਏ ਸਵਾਰੀ ਹੈ ਭਾਅ ਜੀ ਵੀਹ ਰੁਪਏ ਦਾ ਮੁਸ਼ਕਿਲ ਹੋ ਜਾਣੀ ਹੈ ਕਿਉਂਕਿ ਬੰਦੇ ਨਹੀਂ ਮਿਲਦੇ ਰਹਿੰਦੇ ਭਾਅ ਜੀ ਫਿਰ ਤੇਲ ਦਾ ਵੀ ਖਰਚਾ ਕੱਢਣਾ ਬੰਦੇ ਬੜੇ ਘੱਟ ਮਿਲਦੇ ਆ ਇੱਦਾਂ ਬੱਸਾਂ 'ਚ ਨਿਕਲ ਜਾਂਦੇ ਆ ਬੰਦੇ ਜੇ ਤੁਹਾਡੇ ਨਾਲ ਕੋਈ ਹੋਰ ਹੈ ਤਾਂ ਬੰਦੇ ਹੋ ਜਾਣਗੇ ਅਤੇ ਨਿਕਲ ਜਾਂਗੇ ਨਹੀਂ ਤਾਂ ਫਿਰ ਭਾਅ ਜੀ ਟਾਈਮ ਲੱਗ ਜਾਣਾ ਥੋੜ੍ਹਾ ਫਿਰ ਜਾਂ ਤਾਂ ਤੁਸੀਂ ਇੱਦਾਂ ਕਰੋ ਰਿਜ਼ਰਵ ਕਰ ਲਓ ਭਾਅ ਜੀ ਪੰਜਾਹ ਰੁਪਈਏ ਹਾਂਜੀ ਮੈਂ ਕਿਹਾ ਰਿਜ਼ਰਵ ਕਰ ਲਓ ਜਾਂ ਤਾਂ ਫਿਰ ਪੰਜਾਹ ਰੁਪਏ 'ਚ ਇੱਦਾਂ ਭਾਅ ਜੀ ਟਾਈਮ ਬੜਾ ਲੱਗਣਾ ਮਹਾਰਾਜ ਤੋਂ ਨਾ ਤੁਹਾਡਾ ਨਾ ਮੇਰਾ ਨਾ ਤੁਹਾਡਾ ਨਾ ਮੇਰਾ ਪੱਚੀ ਰੁਪਏ ਮਹਾਰਾਜ ਇਸ ਤੋਂ ਥੱਲੇ ਤਾਂ ਤੇਲ ਨਹੀਂ ਪੂਰਾ ਹੋਣਾ ਤੁਸੀਂ ਕੀ ਲੈ ਕੇ ਜਾਣਾ ਮਹਾਰਾਜ ਤੋਂ ਮੇਰੇ ਵੀ ਮੇਰਾ ਵੀ ਘਰ ਹੈ ਮੇਰਾ ਵੀ ਸੋਚੋ ਠੀਕ ਹੈ ਠੀਕ ਹੈ ਭਾਅ ਜੀ ਠੀਕ ਹੈ ਕੋਈ ਗੱਲ ਨਹੀਂ ਕਰ ਲਾਂਗੇ ਕਰ ਲਾਂਗੇ